ਸਤਿ ਸ਼੍ਰੀ ਅਕਾਲ ਜੀ ਭਾਰਤ ਵਿੱਚ ਸਭ ਨੂੰ ਚਾਹ ਬੜੀ ਪਸੰਦ ਹੈ ਅਤੇ ਮੈਨੂੰ ਵੀ ਬਹੁਤ ਜ਼ਿਆਦਾ ਪਸੰਦ ਹੈ ਅੱਜ ਮੈਂ ਤੁਹਾਨੂੰ ਆਪਣਾ ਤਰੀਕਾ ਦੱਸਣ ਜਾ ਰਹੀ ਹਾਂ ਕਿ ਚਾਹ ਕਿਸ ਤਰ੍ਹਾਂ ਬਣਾਉਣੀ ਚਾਹੀਦੀ ਆ ਸਭ ਤੋਂ ਪਹਿਲੇ ਮੈਂ ਫਰਾਈਬੀਨ ਨੂੰ ਗੈਸ 'ਤੇ ਰੱਖ ਕੇ ਗੈਸ ਬਾਲ ਕੇ ਉਸ ਵਿੱਚ ਪਾਣੀ ਪਾਉਂਦੀ ਹਾਂ ਫਿਰ ਉਸ ਵਿੱਚ ਤੋਂ ਬਾਅਦ ਵਿੱਚ ਮੈਂ ਪੱਤੀ ਪਾਉਂਦੀ ਹਾਂ ਪੱਤੀ ਦੇਸੀ ਵਰਤਦੀ ਹਾਂ ਕਿਉਂਕਿ ਭਾਵ ਬਹੁਤ ਸਾਰੀਆਂ ਪੱਤੀਆਂ ਮਿਲਾਵਟ ਨਾਲ ਬਣ ਕੇ ਆ ਰਹੀਆਂ ਹਨ ਪੱਤੀ ਪਾਉਣ ਤੋਂ ਬਾਅਦ ਜਿਸ ਹਿਸਾਬ ਨਾਲ ਜਿੰਨੇ ਕੱਪ ਚਾਹ ਪਾਉਣੀ ਹੁੰਦੀ ਹੈ ਮੈਂ ਉਸ ਵਿੱਚ ਖੰਡ ਪਾਉਂਦੀ ਹਾਂ ਖੰਡ ਪਾ ਕੇ ਮੈਂ ਵ ਸਹੀ ਸਹੀ ਸਹੀ ਵਰਤਦੀ ਹਾਂ ਕੋਈ ਕਈ ਪ੍ਰਕਾਰ ਦੀ ਖੰਡ ਮਿਲਾਵਟ ਵਾਲੀ ਆਉਂਦੀ ਆ ਪਰ ਮਿਲਾਵਟ ਵਾਲੀ ਨਹੀਂ ਵਰਤਦੀ ਉਸ ਤੋਂ ਬਾਅਦ ਖੰਡ ਪਾਉਣ ਤੋਂ ਬਾਅਦ ਮੈਂ ਦੁੱਧ ਪਾਉਂਦੀ ਹਾਂ ਦੁੱਧ ਵੀ ਮੈਂ ਮਿਲਾਵਟ ਵਾਲਾ ਨਹੀਂ ਵਰਤਦੀ ਕਿਉਂਕਿ ਅੱਜ ਕੱਲ੍ਹ ਬੜੇ ਮਿਲਾਵਟ ਵਾਲੇ ਦੁੱਧ ਪਾਊਡਰ ਪਾ ਕੇ ਆ ਰਹੇ ਹਨ ਇਸ ਲਈ ਮੈਂ ਖੁਦ ਜਾ ਕੇ ਸੱਜਰਾ ਦੁੱਧ ਕ ਦੁੱਧ ਚੋ ਕੇ ਉਹ ਦੁੱਧ ਪਾਉਂਦੀ ਹਾਂ ਦੁੱਧ ਪਾਉਣ ਤੋਂ ਬਾਅਦ ਮੈਂ ਉਸ ਵਿੱਚ ਅਦਰਕ ਪਾਉਂਦੀ ਹਾਂ ਅਤੇ ਵਧੀਆ ਬਣਾ ਦਿੰਦੀ ਹਾਂ ਚਾਹ ਨੂੰ ਚੁ ਚੁਸਤੀ ਫੁਰਤੀ ਵਾਲੀ ਚਾਹ ਬਣ ਜਾਂਦੀ ਆ ਉਸ ਤੋਂ ਬਾਅਦ ਉਸ ਦੀ ਇਲਾਚੀ ਪਾਉਂਦੀ ਹਾਂ ਅਤੇ ਅਜਵਾਇਣ ਪਾਉਂਦੀ ਹਾਂ ਮਸਾਲਾ ਪਾਉਂਦੀ ਹਾਂ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਪਾਉਂਦੀ ਹਾਂ ਮਸਾਲੇ ਵੀ ਮਿਲ ਜਾਂਦੇ ਹਨ ਤਾਂ ਸਾਨੂੰ ਦੁਕਾਨਾਂ 'ਤੇ ਦੁਕਾਨਾਂ ਤੋਂ ਪਰ ਇਨ੍ਹਾਂ ਚੀਜ਼ਾਂ ਦੀ ਇਸਤੇਮਾਲ ਕਰਦੀ ਹਾਂ ਜ਼ਿਆਦਾ ਚਾਹ ਨਹੀਂ ਪਾਉਂਦੀ ਫਿਰ ਉਸਨੂੰ ਪੰਜ ਦਸ ਮਿੰਟ ਰਿੰਨ੍ਹਦੀ ਹੈ ਅਤੇ ਚਾਹ ਬਹੁਤ ਰਿੰਨ੍ਹਦੀ ਹੈ ਅਤੇ ਚਾਹ ਬਹੁਤ ਵਧੀਆ ਬਣ ਜਾਂਦੀ ਹੈ